ਜਿਵੇਂ ਕਿ ਬਹੁਤ ਹੀ ਖ਼ਤਰਨਾਕ ਕੀੜੇ ਮਕੌੜੇ ਹਨ ਜਿਵੇਂ ਕਿ ਸੱਪ ਹੋ ਗਿਆ ਭੂੰਡ ਹੋ ਗਿਆ ਮਧੂ ਮੱਖੀ ਦਾ ਡੰਗ ਹੋ ਗਿਆ ਬਹੁਤ ਖ਼ਤਰਨਾਕ ਡੰਗ ਹੁੰਦੇ ਹਨ ਜਿਵੇਂ ਕਿ ਡੰਗ ਵੱਜਣ 'ਤੇ ਅਸੀਂ ਰੱਜ ਕੇ ਪਾਣੀ ਪੀ ਲੈਂਦੇ ਹਾਂ ਅਤੇ ਉਹਦੇ ਨਾਲ ਸਾਨੂੰ ਫਾਇਦਾ ਹੁੰਦਾ ਹੈ ਪੈਟਰੋਲ ਵੀ ਲਗਾ ਲੈਂਦੇ ਹਾਂ ਡੰਗ ਵਾਲੀ ਜਗ੍ਹਾ 'ਤੇ ਉਹਦੇ ਨਾਲ ਸਾਨੂੰ ਬਹੁਤ ਠੰਡਕ ਵੀ ਮਿਲਦੀ ਹੈ ਅਤੇ ਉਸ ਨੂੰ ਠੀਕ ਕਰਨ ਵਾਸਤੇ ਅਸੀਂ ਲੋਹਾ ਜਾਂ ਲੋਹੇ ਦਾ ਤਾਲਾ ਹੋ ਗਿਆ ਜਾਂ ਕੋਈ ਹੋਰ ਲੋਹੇ ਦੀ ਚੀਜ਼ ਹੋ ਗਈ ਅਸੀਂ ਉਸ ਨੂੰ ਰਗੜ ਦਿੰਦੇ ਹਾਂ ਉਸ ਨਾਲ ਸਾਨੂੰ ਸੋਜ ਘੱਟ ਚੜਦੀ ਹੈ ਅਤੇ ਅਸੀਂ ਉਸ ਡੰਗ ਉਤੇ ਪੇਸਟ ਵੀ ਲਗਾ ਲੈਂਦੇ ਹਾਂ ਉਸ ਦਾ ਵੀ ਸਾਨੂੰ ਬਹੁਤ ਫਾਇਦਾ ਹੁੰਦਾ ਹੈ ਹਲਦੀ ਅਤੇ ਤੇਲ ਦਾ ਲੇਪ ਬਣਾ ਕੇ ਵੀ ਅਸੀਂ ਡੰਗ ਉਪਰ ਲਗਾਉਂਦੇ ਹਾਂ ਉਸ ਨਾਲ ਵੀ ਸਾਡਾ ਡੰਗ ਕਾਫੀ ਜਲਦੀ ਠੀਕ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਜ਼ਹਿਰੀਲੇ ਡੰਗ ਠੀਕ ਕਰਨ ਨਾਲ ਕਰਨ ਵਾਸਤੇ ਸਾਡੇ ਪਿੰਡ ਵਿੱਚ ਕਾਫੀ ਘਰੇਲੂ ਨੁਸਖੇ ਹਨ ਜਿਨ੍ਹਾਂ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਹੈ